ਦੋਸਤੋ ਪਾਣੀ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਹੈ ਪਾਣੀ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਪਾਣੀ ਸਾਡੇ ਹਰ ਕੰਮ ਦੇ ਲਈ ਜ਼ਰੂਰੀ ਹੈ ਭਾਵੇਂ ਖਾਣ ਪੀਣ ਦੀ ਗੱਲ ਕਰੀਏ ਭਾਵੇਂ ਰਹਿਣ ਸਹਿਣ ਦੀ ਗੱਲ ਕਰੀਏ ਭਾਵੇਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਸੋ ਪਾਣੀ ਹਰ ਇੱਕ ਦੇ ਲਈ ਜ਼ਰੂਰੀ ਹੈ ਹੁਣ ਜੇਕਰ ਪਾਣੀ ਦੀ ਗੱਲ ਕਰੀਏ ਪਾਣੀ ਨੂੰ ਸ਼ੁੱਧ ਕਰਨ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਹਨ ਪੁਰਾਣੇ ਸਮੇਂ ਵਿੱਚ ਲੋਕ ਪਾਣੀ ਨੂੰ ਉਬਾਲ ਕੇ ਉਹਨੂੰ ਫਿਲਟਰ ਕਰਦੇ ਸੀ ਉਹਨੂੰ ਸ਼ੁੱਧ ਕਰਦੇ ਸੀ ਪਰ ਅੱਜ ਕੱਲ੍ਹ ਇਲੈਕਟ੍ਰੋਨਿਕ ਯੰਤਰ ਬਣ ਗਏ ਨੇ ਫਿਲਟਰ ਬਣ ਗਏ ਨੇ ਜਿਹਦੇ ਨਾਲ਼ ਜਿਹੜਾ ਪਾਣੀ ਹੈ ਉਹ ਸ਼ੁੱਧ ਕੀਤਾ ਜਾਂਦਾ ਏ ਜੇਕਰ ਅਸੀਂ ਵੀ ਆਪਣੇ ਘਰੇਲੂ ਉਪਚਾਰ ਦੇ ਨਾਲ਼ ਪਾਣੀ ਸ਼ੁੱਧ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਇਹ ਹੈ ਕਿ ਪਾਣੀ ਨੂੰ ਅਸੀਂ ਗਰਮ ਕਰਕੇ ਫਿਰ ਵਰਤੀਏ ਕਿਉਂਕਿ ਜਿਹੜੇ ਇਲੈਕਟ੍ਰੋਨਿਕ ਫਿਲਟਰ ਨੇ ਉਹਦੇ ਨਾਲ਼ ਕਈ ਵਾਰੀ ਪਾਣੀ ਵਿੱਚ ਜੋ ਜ਼ਰੂਰੀ ਅਹਿਮ ਤੱਤ ਨੇ ਜਿਹੜੇ ਸਾਡੇ ਸਰੀਰ ਲਈ ਜ਼ਰੂਰੀ ਨੇ ਉਹ ਤੱਤ ਕਈ ਵਾਰੀ ਨੁਕਸਾਨੇ ਜਾਂਦੇ ਹਨ ਉਹ ਤੱਤਾਂ ਦੀ ਕਮੀ ਹੋ ਜਾਂਦੀ ਹੈ ਪ੍ਰੰਤੂ ਸਭ ਤੋਂ ਜਿਹੜਾ ਬਿਹਤਰ ਤਰੀਕਾ ਪਾਣੀ ਨੂੰ ਫਿਲਟਰ ਕਰਨ ਦਾ ਉਹ ਹੈ ਕਿ ਪਾਣੀ ਨੂੰ ਅਸੀਂ ਉਬਾਲ ਕੇ ਔਰ ਫਿਰ ਇਹਨੂੰ ਪੀਈਏ ਇਹਦੇ ਨਾਲ਼ ਸਾਡਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਰਹੇਗਾ ਧੰਨਵਾਦ